ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ ਪਰ ਜ਼ਿਆਦਾਤਰ ਮੈਨੂੰ ਕਿਤਾਬਾਂ ਪੜ੍ਹਨ ਵਿੱਚ ਜਿਵੇਂ ਕਿ ਸਟੋਰੀ ਵਾਲੀਆਂ ਕੋਈ ਇਤਿਹਾਸਿਕ ਧਾਰਮਿਕ ਵਾਲੀਆਂ ਹੀ ਪੜ੍ਹਨ ਦਾ ਜ਼ਿਆਦਾ ਸ਼ੌਂਕ ਹੈ ਅਤੇ ਮੈਂ ਅੱਜ ਤੱਕ ਜ਼ਿਆਦਾਤਰ ਬੁੱਕਸ ਕਹਾਣੀ ਵਾਲੀਆਂ ਹੀ ਪੜ੍ਹੀਆਂ ਨੇ ਇਸ ਕਰਕੇ ਮੈਂ ਇੱਕ ਬੁੱਕ ਖਰੀਦੀ ਸੀ ਰਾਣੀ ਤੱਤ ਇਸ ਵਿੱਚ ਕੁਛ ਜਿੱਦਾਂ ਉਹ ਕਵਿਤਾਵਾਂ ਦੇ ਟਾਈਪ ਵਾਲੀ ਬੁੱਕ ਸੀ ਪੈਰ੍ਹੇ ਹੁੰਦੇ ਆ ਜਦ ਮੈਂ ਇਹਨੂੰ ਪੜ੍ਹਨਾ ਸਟਾਰਟ ਕੀਤਾ ਤਾਂ ਮੇਰਾ ਇੰਟਰਸਟ ਨਹੀਂ ਇਸ 'ਚ ਬਣ ਰਿਹਾ ਸੀਗਾ ਕਿਉਂਕਿ ਮੈਨੂੰ ਜ਼ਿਆਦਾਤਰ ਉਹ ਕਹਾਣੀ ਜੀ ਵਾਲੀਆਂ ਬੁੱਕਸ ਦੀ ਪਸੰਦ ਸੀਗੀਆਂ ਜਦ ਮੈਂ ਇਹਨੂੰ ਹੌਲੀ ਹੌਲੀ ਪੜ੍ਹਨਾ ਸ਼ੁਰੂ ਕੀਤਾ ਅਤੇ ਜਿਹੜੀ ਬੁੱਕ ਸੀਗੀ ਜਦੋਂ ਲਿਖੀ ਹੋਈ ਸੀ ਇਹਦੀ ਹਰ ਇੱਕ ਚੀਜ਼ ਕੁਦਰਤ ਨਾਲ ਰਿਲੇਟ ਕਰਕੇ ਆਪਣੀ ਜ਼ਿੰਦਗੀ ਨਾਲ ਉਹ ਉਹਦਾ ਇੱਕ ਸੰਬੰਧ ਬਣਾਇਆ ਹੋਇਆ ਸੀਗਾ ਕੁਦਰਤ 'ਚ ਵੀ ਉਹੀ ਚੀਜ਼ ਹੁੰਦੀ ਹੈ ਜੋ ਵੀ ਆਪਣੀ ਜ਼ਿੰਦਗੀ 'ਚ ਹੁੰਦੀ ਹੈ ਅਤੇ ਉਹ ਬੜੀ ਸੋਹਣੀ ਲਿਖੀ ਹੋਈ ਸੀ ਜਿਵੇਂ ਕਿ ਉਸ 'ਤੇ ਅੱਜ ਕੱਲ੍ਹ ਬਹੁਤ ਸਾਰੇ ਸੌਂਗ ਵੀ ਗਾਏ ਜਾਂਦੇ ਨੇ ਉਹ ਸੋ ਉਹਨਾਂ ਲਾਈਨਾਂ ਉੱਪਰ ਕੁਛ ਸ਼ਾਇਰੀ ਵੀ ਕੀਤੀ ਜਾਂਦੀ ਹੈ ਉਹਨਾਂ ਲਾਈਨਾਂ ਨੂੰ ਹੀ ਲੈ ਕੇ ਸ਼ਇਰੀ ਕੀਤੀ ਜਾਂਦੀ ਹੈ